ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਅੰਕਲ ਜੀ ਇੱਥੇ ਸਭ ਤੋਂ ਪਹਿਲਾਂ ਤਾਂ ਗੋਲ ਗੋਲਡਨ ਟੈਂਪਲ ਹੈਗਾ ਜੇ ਦਰਬਾਰ ਸਾਹਿਬ ਜੀ ਦੀ ਬਹੁਤ ਮਹਾਨਤਾ ਹੈਗੀ ਹੈ ਅਤੇ ਅਤੇ ਇੱਕ ਸ਼ਹੀਦਾ ਸਾਹਿਬ ਹੈਗਾ ਜੇ ਉੱਥੇ ਵੀ ਮਤਲਬ ਬਹੁਤ ਜ਼ਿਆਦਾ ਮਹਾਨਤਾ ਲੋਕ ਆਉਂਦੇ ਦੂਰੋਂ ਦੂਰੋਂ ਮੱਥਾ ਟੇਕਣ ਦੁਰਗਿਆਨਾ ਮੰਦਿਰ ਹੈਗਾ ਜੇ ਅਤੇ ਵੀਵੇਕਸਰ ਹੈਗਾ ਜੇ ਰਾਮਸਰ ਹੈਗਾ ਜੇ ਇਹ ਸਾਰੇ ਜਿਹੜੀਆਂ ਆਸੇ ਪਾਸੇ ਜਿਹੜੇ ਹੈਗੇ ਐ ਇਹ ਸਾਰੇ ਮਤਲਬ ਨੇੜੇ ਨੇੜੇ ਹੀ ਹੈਗੇ ਜੇ ਬਾਬਾ ਸਰ ਚੌਕ ਵਿੱਚ ਹੀ ਹੈਗੇ ਜੇ ਸਾਰੇ ਤੁਸੀਂ ਮਤਲਬ ਜਿਵੇਂ ਦਿਨੇ ਤੁਸੀਂ ਨਿਕਲਦੇ ਹੋ ਤੁਸੀਂ ਸ਼ਾਮ ਤੱਕ ਸਾਰੇ ਗੁਰਦੁਆਰੇ ਘੁੰਮ ਸਕਦੇ ਹੋ ਬੜੇ ਆਰਾਮ ਨਾਲ ਹਾਂਜੀ ਨਾਲ ਨਾਲ ਹੀ ਨੇ ਬਿਲਕੁਲ ਥੋੜ੍ਹਾ ਥੋੜ੍ਹਾ ਅੱਧੇ ਅੱਧੇ ਘੰਟੇ ਘੰਟੇ ਦਾ ਫ਼ਰਕ ਹੈ ਅਤੇ ਉਹ ਇੱਥੇ ਇੱਥੇ ਆਸੇ ਪਾਸੇ ਇੱਕ ਉਹ ਵੀ ਹੈਗਾ ਦੁਰਗਿਆਨਾ ਮੰਦਿਰ ਵੀ ਹੈਗਾ ਜੇ ਉਹ ਵੀ ਅੱਧੇ ਘੰਟੇ ਦਾ ਰਸਤਾ ਤੁਸੀਂ ਉੱਥੇ ਵੀ ਦਰਸ਼ਨ ਕਰ ਸਕਦੇ ਹੋ ਆਰਾਮ ਨਾਲ ਅਤੇ ਤੁਸੀਂ ਜਲ੍ਹਿਆਂਵਾਲਾ ਬਾਗ ਹੈਗਾ ਤੁਸੀਂ ਉਹ ਵੀ ਵੇਖ ਸਕਦੇ ਹੋ ਹੁਣ ਤਾਂ ਪ ਪੂਰਾ ਨਵਾਂ ਬਣ ਗਿਆ ਹੈ ਜੇ ਅਤੇ ਬੜੇ ਲੋਕ ਆਉਂਦੇ ਉੱਥੇ ਵੀ ਵੇਖਣ ਠੀਕ ਹੈ ਥੈ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ